ਪੰਜਾਬੀ ਸਾਡੀ ਮਾਤ ਭਾਸ਼ਾ ਜੇ ਸਾਡੇ ਮ ਬ ਜਨੇਸ਼ ਜਦੋਂ ਅਸੀਂ ਮਾਂ ਦੇ ਪਏ ਸਿੱਖਦੇ ਹਾਂ ਤਾਂ ਸ਼ੁਰੂ ਤੋਂ ਅਸੀਂ ਪੰਜਾਬੀ ਸਿੱਖਦੇ ਹਾਂ ਬੱਚਾ ਜਦੋਂ ਛੋਟਾ ਹੁੰਦਾ ਫਿਰ ਉਸ ਤੋਂ ਬਾਅਦ ਸਾਡੀ ਪੰਜਾਬੀ ਜਿਹੜੀ ਆ ਕਿ ਸਾਰੇ ਸੰਸਾਰ 'ਚ ਨਹੀਂ ਬੋਲ ਸਕਦੇ ਅਸੀਂ ਅਤੇ ਸਾਡੀ ਬੋਲੀ ਆ ਵੀ ਅਸੀਂ ਇਸ ਤਰ੍ਹਾਂ ਮਤਲਬ ਆਪਣੇ ਪੰਜਾਬ ਦੇ ਵਿੱਚ ਹੀ ਅਸੀਂ ਇਹਨੂੰ ਬੋਲ ਸਕਦੇ ਹਾਂ ਅਤੇ ਚੁਣੌਤੀਆਂ ਇਹਨੂੰ ਇਹ ਹੋਣਗੀਆਂ ਕਿ ਜਦੋਂ ਮੰਨ ਲਓ ਵੀ ਅਸੀਂ ਆ ਬਾਹਰ ਸਟੇਟ ਵਿੱਚ ਜਾਂਦੇ ਹਾਂ ਅਤੇ ਜੇ ਸ ਸਾਨੂੰ ਉੱਥੇ ਸਾਡੀ ਇਕੱਲੀ ਅਸੀਂ ਪੰਜਾਬੀ ਨਹੀਂ ਬੋਲ ਸਕਦੇ ਜਾਂ ਤਾਂ ਸਾਨੂੰ ਸਨ ਹਿੰਦੀ ਬੋਲਣੀ ਪਊਗੀ ਗੁਜਰਾਤ 'ਚ ਜਾਵਾਂਗੇ ਗੁਜਰਾਤੀ ਮਰਾ ਹੋਰ ਕਿਤੇ ਜਾਵਾਂਗੇ ਮਰਾਠੀ ਤਾਮਿਲ ਤੇਲਗੂ ਇਹ ਭਾਸ਼ਾ ਸਿੱਖਣੀਆਂ ਬੋਲਣੀਆਂ ਪੈਣਗੀਆਂ ਜਿੱਥੇ ਕਿ ਹਰ ਥਾਂ ਪੰਜਾਬੀ ਨਹੀਂ ਚੱਲ ਸਕਦੀ ਅਤੇ ਮ ਮੇਨ ਚੀਜ਼ ਆ ਕਿ ਜਿਹੜੇ ਸ ਅਸੀਂ ਇੱਥੋਂ ਬਾਹਰ ਜਾ ਰਹੇ ਹਾਂ ਬਾਹਰ ਜਾ ਕੇ ਸਾਡੇ ਬੱਚੇ ਉੱਥੇ ਹੋ ਰਹੇ ਆ ਬੱਚੇ ਉੱਥੋਂ ਦੀ ਭਾਸ਼ਾ ਇੰਗਲਿਸ਼ ਸਿੱਖਦੇ ਉਨ੍ਹਾਂ ਨੂੰ ਪੰਜਾਬੀ ਨਹੀਂ ਉਹ ਸਹੀ ਤਰੀਕੇ ਨਾਲ ਬੋਲ ਸਕਦੇ ਅਤੇ ਉਨ੍ਹਾਂ ਨੂੰ ਕੋਈ ਸਹੀ ਸਿਖਾਉਣ ਵਾਲਾ ਵੀ ਹੈ ਨਹੀਂ ਆ ਇਸ ਕਰਕੇ ਉਹ ਸਹੀ ਨਹੀਂ ਬੋਲ ਸਕਦੇ ਅਤੇ ਇਹੋ ਸਾਡੀ ਮਤਲਬ ਪੰਜਾਬੀ 'ਚ ਜਿਹੜੀਆਂ ਚੁਣੌਤੀਆਂ ਨਾ ਉਹ ਬੱਚਿਆਂ ਨੂੰ ਆ ਰਹੀਆਂ ਅਤੇ ਇਹੋ ਹੀ ਗੱਲ ਹੈ ਕਿ ਅਸੀਂ ਉੱਥੇ ਸਿੱਖ ਸਖਾ ਸਕ ਸਿੱਖਦੇ ਨਹੀਂ ਹਾਂ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਪੰਜਾਬੀ ਕਿਵੇਂ ਬੋਲਣੀ ਹੈ